ਸਾਡੇ ਇੱਥੇ ਦੇ ਇਲਾਕੇ ਦੇ ਵਿੱਚ ਥੋੜ੍ਹੀ ਥੋੜ੍ਹੀ ਦੂਰੀ 'ਤੇ ਹੀ ਏ ਟੀ ਐੱਮ ਬਣੇ ਹੋਏ ਨੇ ਅਤੇ ਉੱਥੇ ਦੀ ਜਿਹੜੀ ਸਰਵਿਸ ਹੈ ਉਹ ਬਹੁਤ ਹੀ ਵਧੀਆ ਹੈ ਅਤੇ ਜਿਹੜੇ ਬੈਂਕ ਨੇ ਉਹ ਵੀ ਬਹੁਤ ਅੱਛੀ ਸੇਵਾਵਾਂ ਦਿੰਦੇ ਨੇ